ਮੇਰੀ ਤਰਜੀਹ ਇੰਟਰਨੈੱਟ ਬੈਂਕਿੰਗ ਲਈ ਹੈ ਕਿਉਂਕਿ ਅੱਜ ਕੱਲ੍ਹ ਇੰਟਰਨੈੱਟ ਅ ਬੈਂਕਿੰਗ ਇੰਨੀ ਚੱਲ ਪਈ ਹੈ ਕਿਉਂਕਿ ਇਹ ਅਸਾਨੀ ਨਾਲ ਆਪਾਂ ਨੂੰ ਕਿਤੇ ਵੀ ਮਿਲ ਸਕਦੀ ਹੈ ਆਪਾਂ ਇਹਨੂੰ ਕਦੀ ਵੀ ਆਵਾਜੈਂਸੀ ਆਪਾਂ ਨੂੰ ਪੈਸੇ ਚਾਹੀਦੇ ਨੇ ਆਪਾਂ ਕਦੀ ਵੀ ਕਿਤੋਂ ਵੀ ਲਿਜਾ ਸਕਦੇ ਹਾਂ ਆਸਾਨੀ ਨਾਲ ਉਸਨੂੰ ਉਹ ਕਰ ਸਕਦੇ ਹਾਂ ਵਰਤ ਸਕਦੇ ਹਾਂ ਸਪੋਜ ਕਰੋ ਵੀ ਅਸੀਂ ਕਿਸੇ ਰਿਸ਼ਤੇਦਾਰੀ 'ਚ ਗਏ ਸਾਨੂੰ ਉੱਥੇ ਸਾਡੇ ਇੱਕ ਦੋ ਦਿਨ ਵੱਧ ਲੱਗ ਗਏ ਸਾਡੇ ਕੋਲ ਪੈਸੇ ਘੱਟ ਗਏ ਤਾਂ ਅਸੀਂ ਆਪਣੇ ਬੈਂਕ ਦੀ ਕਾਪੀ ਤਾਂ ਨਾਲ ਲੈ ਕੇ ਜਾ ਨਹੀਂ ਸਕਦੇ ਕਿਉਂਕਿ ਆਪਾਂ ਹਰ ਥਾਂ ਤਾਂ ਨਹੀਂ ਆਪਣੀ ਬੈਂਕ ਦੀ ਕਾਪੀ ਲੈ ਕੇ ਜਾ ਸਕਦੇ ਪਰ ਹਾਂਜੀ ਜੇ ਸਾਡੇ ਕੋਲ ਇੱਕ ਔਨਲਾਈਨ ਦੀ ਸੁਵਿਧਾ ਹੈ ਤਾਂ ਆਪਾਂ ਉਹਨੂੰ ਅਸਾਨੀ ਨਾਲ ਆਪਣੇ ਪੈਸਿਆਂ ਨੂੰ ਵਰਤ ਸਕਦੇ ਹਾਂ ਇਸ ਨਾਲ ਆਪਾਂ ਨੂੰ ਕਦੇ ਵੀ ਕਿਤੇ ਪਰੇਸ਼ਾਨੀ ਦੇ ਵਿੱਚ ਕਦੇ ਵੀ ਕਿਤੇ ਲੋੜ ਪੈ ਸਕਦੀ ਪਵੇ ਤਾਂ ਆਪਾਂ ਇਹਨੂੰ ਆਰਾਮ ਦੇ ਨਾਲ ਕਿਤੇ ਨਾ ਕਿਤੇ ਲਿਜਾ ਸਕਦੇ ਹਾਂ ਕਿਉਂਕਿ ਇਹਦੇ ਨਾਲ ਇੱਕ ਤਾਂ ਆਸਾਨੀ ਬੈਂ ਉਹ ਆ ਦੂਜਾ ਆਪਾਂ ਨੂੰ ਪੈਸਿਆਂ ਦਾ ਚੋਰੀ ਹੋਣ ਦਾ ਡਰ ਨਹੀਂ ਹੈ ਵੀ ਕੋਈ ਪੈਸੇ ਪੋਕਿਟ ਵਿੱਚੋਂ ਕੱਢ ਲੂਗਾ ਬੈ ਸਫਰ ਕਰ ਰਹੇ ਹਾਂ ਕੋਈ ਪਰਸ ਵਿੱਚੋਂ ਸਾਡੇ ਪੈਸੇ ਕੱਢ ਲੂਗਾ ਜਾਂ ਕੋਈ ਟ੍ਰੇਨ ਦੇ ਵਿੱਚੋਂ ਕੱਢ ਲੂਗਾ ਇਸ ਚੀਜ਼ ਤੋਂ ਆਰਾਮਦਾਇਕ ਆ ਵੀ ਆਪਣੇ ਇੱਕ ਫੋਨ ਹੋਣਾ ਚਾਹੀਦਾ ਇੱਕ ਨੈੱਟ ਦੀ ਫੈਸਿਲਟੀ ਹੋਣੀ ਚਾਹੀਦੀ ਹੈ ਆਪਾਂ ਆਪਣੇ ਪੈਸੇ ਕਿਤੇ ਵੀ ਕਰ ਸਕਦੇ ਆ ਦੂਜਾ ਇਹ ਹੈ ਵੀ ਕਦੀ ਆਪਾਂ ਨੂੰ ਖੁੱਲ੍ਹੇ ਪੈਸਿਆਂ ਦੀ ਲੋੜ ਪੈ ਜਾਂਦੀ ਵੀ ਸਾਨੂੰ ਤਿਹੱਤਰ ਰੁਪਏ ਚਾਹੀਦੇ ਚੌਹੱਤਰ ਚਾਹੀਦਾ ਦੋ ਤਿੰਨ ਰੁਪਏ ਖੁੱਲ੍ਹੇ ਨਹੀਂ ਮਿਲਦੇ ਇਹਨਾਂ ਵਿੱਚ ਉਹ ਦਿੱਕਤ ਖਤਮ ਹੋ ਜਾਂਦੀ ਹੈ ਸਿੱਧੀ ਦੀ ਸਿੱਧੀ ਆਪਾਂ ਜਿੰਨੇ ਪੈਸੇ ਪੇਮੈਂਟ ਕਿਸੇ ਨੂੰ ਕਰਨੀ ਉਨੀ ਕਰ ਸਕਦੇ ਹਾਂ